ਹੈਲੋ ਵੀਰੇ ਕਿਵੇਂ ਹੋ ਉਮੀਦ ਕਰਦੀ ਹਾਂ ਕੀ ਤੁਸੀਂ ਠੀਕ ਠਾਕ ਹੋਵੋਗੇ ਮੈਨੂੰ ਤੁਹਾਡਾ ਕੱਲ ਹੀ ਸੰਦੇਸ ਮਿਲਿਆ ਹੈ ਮੈਨੂੰ ਉਸ ਤੋਂ ਪਤਾ ਲੱਗਾ ਹੈ ਕੀ ਤੁਹਾਨੂੰ ਆਪਨੇ ਪਾਸਪੋਰਟ ਦੀ ਅਰਜ਼ੀ ਲਈ ਮੇਰੇ ਜਨਮ ਸਰਟੀਫਿਕੇਟ ਦੀ ਲੋੜ ਹੈ ਮੇਰਾ ਜਨਮ ਸਰਟੀਫਿਕੇਟ ਡਿਜੀਲੋਕਰ ਵਿੱਚ ਪਾਇਆ ਹੈ ਕੀ ਤੁਸੀਂ ਉੱਥੋਂ ਕਢਵਾ ਸਕਦੇ ਜੇਕਰ ਕਢਵਾ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਤਾਂ ਤੁਸੀਂ ਸਾਡੇ ਕੋਲ ਆ ਜਾਵੋ ਅਤੇ ਸਰਟੀਫੇਟ ਲੈ ਜਾਵੋ ਤੁਹਾਨੂੰ ਜਿਸ ਵਿੱਚ ਦਰਤਾਵੇਜ਼ ਦੀ ਤੁਹਾਨੂੰ ਤੁਹਾਨੂੰ ਦਿਸ ਜੀ ਦਸਤਾਵੇਜ਼ ਦੀ ਲੋੜ ਹੋਈ ਤਾਂ ਮੈਂ ਤੁਹਾਨੂੰ ਦੇ ਦਵਾਂਗੀ ਜੇਕਰ ਤੁਸੀਂ ਆਪਨੇ ਕਿਸੇ ਕੰਮਾਂ ਵਿੱਚ ਵਿਅਸਤ ਹੋ ਤਾਂ ਮੈਂ ਤੁਹਾਡੇ ਕੋਲ ਆ ਕੇ ਤੁਹਾਡੀ ਜ਼ਰੂਰਤ ਦੇ ਸਾਰੇ ਦਸਤਾਵੇਜ਼ ਦੇ ਜਾਵਾਂਗੀ ਅਤੇ ਤੁਹਾਡੇ ਜ਼ਰੂਰਤ ਦਾ ਜੋ ਵੀ ਸਮਾਨ ਹੋਇਆ ਉਹ ਦੇ ਜਾਵਾਂਗੀ ਜੇਕਰ ਤੁਹਾਨੂੰ ਕੁਝ ਹੋਰ ਵੀ ਚਾਹੀਦਾ ਹੈ ਤਾਂ ਸਾਨੂੰ ਦੱਸ ਦਿਓ ਮੈਂ ਤੁਹਾਡੇ ਕੋਲ ਜਲਦੀ ਹੀ ਆਵਾਂਗੀ ਅਤੇ ਤੁਹਾਡੇ ਜਰੂਰੀ ਡਾਕੂਮੈਂਟ ਜੇ ਦਵਾਂਗੀ ਉਮੀਦ ਕਰਦੀ ਹਾਂ ਕੀ ਤੁਸੀਂ ਠੀਕ ਠਾਕ ਹੋਵੋਗੇ ਅਤੇ ਸਾਰੀ ਪਰਿਵਾਰ ਤੁਹਾਡਾ ਸੋਨੂੰ ਯਾਦ ਕਰਦੀ ਹੈ ਜਨਮ ਸਰਟੀਫੇਟ ਤੁਹਾਡੇ ਕੋਲ ਆ ਜਾਵੇਗਾ ਧੰਨਵਾਦ ਜੀ